ਪੰਜਾਬ ਵਿੱਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜੋ ਕਿ ਜਲੰਧਰ ਵਿੱਚ ਹੈ ਉਸ ਤੋਂ ਬਾਅਦ ਲੈਮਰਨ ਯੂਨੀਵਰਸਿਟੀ ਰੈਲ ਮਾਜਰਾ ਨਵਾਂਸ਼ਹਿਰ 'ਚ ਹੈ ਚੰਡੀਗੜ੍ਹ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਜੋ ਕਿ ਗੱਲ ਕਰੀਏ ਪੰਜਾਬੀ ਮੀਡੀਅਮ ਦੇ ਵਿੱਚ ਇਹ ਯੂਨੀਵਰਸਟੀ ਹੈ ਆਈ ਆਈ ਟੀ ਰੋਪੜ ਵੀ ਬਹੁਤ ਬੜੀ ਆਈ ਆਈ ਟੀ ਹੈ ਜਿਸ ਦੇ ਵਿੱਚ ਬੱਚੇ ਪੜ੍ਹ ਲਿਖ ਕੇ ਬਹੁਤ ਬੜੇ ਰੈਂਕ 'ਤੇ ਜਾਂਦੇ ਹਨ ਅਤੇ ਬਹੁਤ ਲੋਕਾਂ ਨੂੰ ਰੁਜ਼ਗਾਰ ਵੀ ਦਿੰਦੀ ਹੈ ਇਹ ਆਈ ਆਈ ਟੀ ਰੋਪੜ ਬਹੁਤ ਵਧੀਆ ਕੈਂਪ ਹੈ